ਇਹ ਮੁਰਗੀਆਂ ਖਰੀਦੀਆਂ ਸੀ ਅਤੇ ਹੁਣ ਅਸੀਂ ਵੇਚ ਦਿੱਤੀਆਂ ਨੇ ਅਸੀਂ ਲੱਖ ਲੱਖ ਲੱਖ ਲੱਖ ਰੁਪਈਏ ਦੀ ਗਾਂਈ ਵੇਚੀ ਹੈ ਅਤੇ ਉਹ ਉਹਦੇ ਨਾਲ ਅਸੀਂ ਘਰ ਦਾ ਗੁਜ਼ਾਰਾ ਕਰਦੇ ਹਾਂ ਸ ਸਾਡੇ ਕੋਲ ਹੋਰ ਵੀ ਗਾਈਆਂ ਹਨ ਉਹਨਾਂ ਦਾ ਦੁੱਧ ਵੇਚ ਕੇ ਅਸੀਂ ਗੁਜ਼ਾਰਾ ਕਰਦੇ ਹਾਂ ਆਪਣਾ ਸਾਡੇ ਕੋਲ ਮੁਰਗੀਆਂ ਵੀ ਹਨ ਅਸੀਂ ਉਨ੍ਹਾਂ ਉਨ੍ਹਾਂ ਨੂੰ ਉਨ੍ਹਾਂ ਨੂੰ ਵੀ ਅਸੀਂ ਵੇਚਦੇ ਹਾਂ ਅਤੇ ਘਰ ਦਾ ਗੁਜ਼ਾਰਾ ਚਲਾਇਆ ਕਰਦੇ ਹਾਂ ਉਹਦੇ ਆਂਡੇ ਵੇਚਦੇ ਹਾਂ ਸਾਡਾ ਗੁਜ਼ਾਰਾ ਚਲਿਆ ਕਰਦਾ

ਹੁਣ ਤਾਂ ਮੁਰਗੀਆਂ ਦੇ ਵੀ ਬੜੇ ਰੇਟ ਹੋਏ ਦੇ ਨੇ ਆ ਵੀਹ ਵੀਹ ਹਜ਼ਾਰ ਦੀ ਤਾਂ ਮੁਰਗੀ ਵਿਕਣ ਡਈ ਦੀ ਹੈ ਸ ਸਾਡੇ ਮੋ ਕੋਲ ਕੁੱਤਾ ਵੀ ਹੈ ਉਹ ਉਹਦੇ ਨਾਲ ਅਸੀਂ ਬੜਾ ਖੇਡਦੇ ਹਾਂ ਕਾਲੇ ਰੰਗ ਦਾ ਕੁੱਤਾ ਹੈ ਨਾਂ ਉਹਦਾ ਕਾਲੂ ਹੈ ਅਸੀਂ ਉਹਦੇ ਨਾਲ ਖੇਡਦੇ ਰਹਿੰਦੇ ਹਾਂ ਦਿਨ ਰਾਤ ਪੰਜਾਹ ਹਜ਼ਾਰ ਦਾ ਕੁੱਤਾ ਹੈ ਅਸੀਂ ਵੇਚਣਾ ਨਹੀਂ ਚਾਹੁੰਦੇ ਕਾਲੀਆਂ ਨਾਲ ਅਤੇ ਕਾਲੇ ਕਾਲਿਆਂ ਕੁੱਤਿਆਂ ਨਾਲ ਤਾਂ